ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਪ੍ਰੀਤ ਕੌਰ ਹੈ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਪਠਾਨਕੋਟ ਵਿੱਚ ਬਹੁਤ ਸਾਰੇ ਘੁੰਮਣ ਫਿਰਨ ਦੇ ਸਥਾਨ ਹਨ ਅਤੇ ਇੱਥੇ ਰਣਜੀਤ ਸਾਗਰ ਡੈਮ ਹੈ ਅਤੇ ਰਣਜੀਤ ਸਾਗਰ ਡੈਮ ਘੁੰਮਣ ਲਈ ਤੁਹਾਨੂੰ ਇੱਕ ਦਿਨ ਪਹਿਲਾਂ ਹੀ ਟਿਕਟ ਕਰਵਾਉਣੀ ਪੈਂਦੀ ਹੈ ਅਤੇ ਇਹ ਟਿਕਟ ਵੀ ਬਿਲਕੁਲ ਫਰੀ ਔਫ ਕੋਸਟ ਹੁੰਦੀ ਆ ਅਤੇ ਅਗਲੇ ਤੁਸੀਂ ਆ ਕੇ ਰਣਜੀਤ ਸਾਗਰ ਡੈਮ ਨੂੰ ਘੁੰਮ ਸਕਦੇ ਹੋ ਅਤੇ ਇੱਥੇ ਮਿੰਨੀ ਗੋਆ ਹੈ ਅਤੇ ਮਿੰਨੀ ਗੋਆ ਜਾਂ ਤੁਸੀਂ ਆਪਣੀ ਵਾਹੀਕਲ 'ਤੇ ਜਾਂ ਕਾ ਵਾਹੀਕਲ 'ਤੇ ਆਉਣਾ ਹੋਏ ਕਾਰ ਮੋਟਰਸਾਈਕਲ ਉਹਦਾ ਸੋ ਦੋ ਸੌ ਦਾ ਤੇਲ ਲੱਗਦਾ ਹੈ ਅਤੇ ਤੁਸੀਂ ਮਿੰਨੀ ਗੋਆ ਜਾ ਕੇ ਵੀ ਘੁੰਮ ਸਕਦੇ ਹੋ ਅਤੇ ਇੱਥੇ ਪਠਾਨਕੋਟ ਵਿੱਚ ਖਾ ਖਾਣ ਪੀਣ ਦਾ ਬਹੁਤ ਸਾਰੇ ਰੇਹੜੀਆਂ ਰੈਸਟੋਰੈਂਟ ਵਗੈਰਾ ਹੈ ਅਤੇ ਮਤਲਬ ਕਿ ਖਾਣ ਪੀਣ ਦਾ ਵੀ ਜੈਨੁਅਲ ਮਤਲਬ ਕਿ ਪ੍ਰਾਈਜ ਅਤੇ ਖਾਣ ਪੀਣ ਦਾ ਮਤਲਬ ਕਿ ਬਹੁਤ ਸਾਰਾ ਇੱਥੇ ਲੱਗਦਾ ਜਿਵੇਂ ਗੋਲ ਗੱਪੇ ਬਰਗਰ ਨਿਊਡਲ ਐਦਾਂ ਦੀ ਬਹੁਤ ਸਾਰੀ ਹੀ ਚਾਂਪਾ ਵਗੈਰਾ ਬਹੁਤ ਸਾਰੀਆਂ ਚੀਜ਼ਾਂ ਲੱਗਦੀਆਂ ਹਨ ਅਤੇ ਤੁਸੀਂ ਇੱਥੇ ਆ ਕੇ ਖਾਣ ਪੀਣ ਦਾ ਵੀ ਆਨੰਦ ਮਾਣ ਸਕਦੇ ਹੋ ਅਤੇ ਇੱਥੇ ਖਾਣ ਪੀਣ ਦਾ ਵੀ ਬਿਲਕੁਲ ਜੈਨੁਅਲ ਜਿਹਾ ਰੇਟ ਹੁੰਦਾ ਹੈ ਅਤੇ ਜੇ ਕੋਈ ਪਠਾਨਕੋਟ ਵਿੱਚ ਆ ਕੇ ਅਤੇ ਇੱਥੇ ਵਿਜ਼ਿਟ ਕ ਕਰੇਗਾ ਉਹਦਾ ਇੰਨਾ ਖਰਚ ਨਹੀਂ ਆਏਗਾ ਉਹਦਾ ਸੌ ਦੋ ਸੌ ਤਿੰਨ ਸੌ ਤੱਕ ਹੀ ਖਰਚਾ ਆਏਗਾ